ਹਾਂਜੀ ਮੈਂ ਚਾਹੁੰਦਾ ਹਾਂ ਕਿ ਆਪਣਾ ਕਿ ਔਰਤਾਂ ਦਾ ਪੇਪਰ ਵਿੱਚ ਅਤੇ ਰੇਡੀਓ ਵਿੱਚ ਇੱਕ ਵਿਸ਼ੇਸ਼ ਸੈਕਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸਿਆ ਜਾ ਸਕੇ ਜਿੱਦਾਂ ਕਿ ਹੁਣ ਪੇਪਰਾਂ ਅਤੇ ਆਪਣਾ ਮੈਗਜੀਨਾਂ ਵਿੱਚ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਜਾਂ ਉਹਨਾਂ ਦੇ ਮੇਕਅਪ ਬਾਰੇ ਦੱਸਿਆ ਜਾਂਦਾ ਹੈ ਪਰ ਉਹਨਾਂ ਨੂੰ ਉਹਨਾਂ ਦੇ ਹੱਕ ਬਾਰੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਜਾਂਦੀ ਕਿ ਇਹਨਾਂ ਦੇ ਹੱਕ ਕਿਹੜੇ ਆ ਕਿਵੇਂ ਆਪਣਾ ਇਹਨੂੰ ਆਪਣਾ ਐਜੂਕੇਟਰੀ ਕੀਤਾ ਜਾ ਸਕਦਾ ਹੈ ਕਿੱਦਾਂ ਨੌਕਰੀਆਂ ਲੈ ਸਕਦੀਆਂ ਹੈ ਅਤੇ ਇਹਨਾਂ ਨੂੰ ਆਪਾਂ ਅੱਗੇ ਕਿੱਦਾਂ ਵਧਾ ਸਕਦੇ ਐ ਇਹਨਾਂ ਬਾਰੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਹੈਗਾ ਮੈਂ ਇਹੀ ਚਾਹੁੰਦਾ ਕਿ ਇਹਨਾਂ 'ਚ ਇੱਕ ਅਲੱਗ ਪੇ ਪੰਨਾ ਹੋਣਾ ਚਾਹੀਦਾ ਹੈ ਜਿਵੇਂ ਮੈਗਜੀਨ ਪੇਪਰ ਪੇਜ ਹੁੰਦਾ ਹੈ ਅਖਬਾਰ ਦਾ ਉਹਨਾਂ ਦਾ ਇੱਕ ਪੇਜ ਹੋਣਾ ਚਾਹੀਦਾ ਅਤੇ ਉਹਦੇ ਵਿੱਚ ਔਰਤਾਂ ਬਾਰੇ ਹੀ ਦੱਸਿਆ ਜਾ ਸਕੇ ਕਿ ਇਹਨਾਂ ਦੀਆਂ ਆਹ ਆਹ ਆਪਣੇ ਫਾਇਦੇ ਲੈ ਸਕਦੀਆਂ ਅਤੇ ਇਹਨਾਂ ਇਹਨਾਂ ਦੇ ਆਹ ਆਪਣੇ ਹੱਕ ਨੇ ਤਾਂ ਜੋ ਅੱਗੇ ਵਧ ਕੇ ਇਹ ਆਪਣੇ ਹੱਕਾਂ ਬਾਰੇ ਮੰਗਣ ਤਾਂ ਜੋ ਆਪਣੇ ਆਪ 'ਤੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਇਹ ਸਭ ਮੈਗਜੀਨਾਂ 'ਚ ਵੀ ਇੱਦਾਂ ਹੋਵੇ ਉਹਨਾਂ ਦੇ ਵੀ ਦੋ ਤਿੰਨ ਪੇਜ ਅਲੱਗ ਬਣਾਏ ਜਾਣ ਕਿ ਜਿੰਨਾ ਵਿੱਚ ਔਰਤਾਂ ਦੇ ਹੱਕਾਂ ਬਾਰੇ ਗੱਲ ਕਰੀ ਜਾਵੇ ਉਦੂੰ ਬਿਨਾਂ ਉਹਨਾਂ ਬਾਰੇ ਕੋਈ ਗੱਲ ਨਾ ਕਰੀ ਜਾਵੇ ਸਿਰਫ ਹੱਕ ਹੋਣ ਉਹਨਾਂ ਦੇ ਵਿੱਚ